ਪੰਜਾਬੀ ਭਾਸ਼ਾ ਆਰੀਆ ਭਾਸ਼ਾ ਪਰਿਵਾਰ ਵਿੱਚੋਂ ਨਿਕਲੀ ਹੋਈ ਭਾਸ਼ਾ ਹੈ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਹੋਰਨਾਂ ਭਾਸ਼ਾਵਾਂ ਜਿਵੇਂ ਹਿੰਦੀ ਸਿੰਧੀ ਕਸ਼ਮੀਰੀ ਸੰਸਕ੍ਰਿਤ ਉਰਦੂ ਬੰਗਾਲੀ ਨੇਪਾਲੀ ਰੋਮਾਨੀ ਅਸਾਮੀ ਗੁਜਰਾਤੀ ਮਰਾਠੀ ਆਦਿ ਭਾਸ਼ਾਵਾਂ ਦੇ ਸ਼ਬਦ ਭੰਡਾਰਾਂ ਨਾਲ ਮੇਲ ਖਾਂਦੇ ਹਨ ਜਿਵੇਂ ਪੰਜਾਬੀ ਵਿੱਚ ਉੱਚਾ ਅਤੇ ਸੰਸਕ੍ਰਿਤ ਵਿੱਚ ਉੱਚਕ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਅੱਜ ਅਤੇ ਹਿੰਦੀ ਵਿੱਚ ਆਜ ਸ਼ਬਦ ਦੀ ਵਰਤੋਂ ਹੁੰਦੀ ਹੈ ਪੰਜਾਬੀ ਵਿੱਚ ਦੁੱਧ ਅਤੇ ਸਿੰਧੀ ਵਿੱਚ ਡੁੱਧ ਸ਼ਬਦ ਦੀ ਵਰਤੋਂ ਹੁੰਦੀ ਹੈ ਪੰਜਾਬੀ ਵਿੱਚ ਅਸੀਂ ਅਤੇ ਕਸ਼ਮੀਰੀ ਵਿੱਚ ਅਸ਼ੇ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਨ੍ਹਾਂ ਭਾਸ਼ਾਵਾਂ ਵਿੱਚ ਇੰਨੀ ਸਮਾਨਤਾ ਹੋਣ ਦਾ ਕਾਰਨ ਇਹ ਹੈ ਕਿ ਇਹ ਸਾਰੀਆਂ ਭਾਸ਼ਾਵਾਂ ਹੀ ਆਰੀਆ ਭਾਸ਼ਾ ਪਰਿਵਾਰ ਵਿੱਚੋਂ ਨਿਕਲੀਆਂ ਹਨ ਸਮੇਂ ਦੇ ਨਾਲ ਨਾਲ ਇਹਨਾਂ ਵਿੱਚੋਂ ਕੁਝ ਭਾਸ਼ਾਵਾਂ ਨੇ ਆਪਣਾ ਪੁਰਾਤਨ ਉਚਾਰਨ ਸਾਂਭ ਕੇ ਰੱਖਿਆ ਅਤੇ ਕੁਝ ਨੇ ਨਵੇਂ ਉਚਾਰਨ ਗ੍ਰਹਿਣ ਕਰ ਲਏ ਪਰ ਇਹ ਪੂਰਨ ਰੂਪ ਵਿੱਚ ਇੱਕ ਦੂਜੇ ਤੋਂ ਬਿਲਕੁਲ ਵੱਖਰੀਆਂ ਨਹੀਂ ਹੋਈਆਂ